ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਰੈਸਟੋਰੈਂਟ ਦੇ ਵਿੱਚ ਆਪਣੇ ਜਨਮਦਿਨ ਦਾ ਸਮਾਨ ਮੰਗਵਾਇਆ ਸੀ ਅਤੇ ਵਧੀਆ ਮੰਗਵਾਇਆ ਸੀ ਖੁੱਲ੍ਹੇ ਹੱਥ ਦਾ ਅਤੇ ਸਾਰੇ ਬਹੁਤ ਹੀ ਜਣੇ ਬੈਠੇ ਹੋਏ ਸੀ ਸਾਡੇ ਦੇ ਬਾ ਬਹੁਤ ਜਣਿਆਂ ਬੁਲਾਏ ਹੋਏ ਸੀ ਅਤੇ ਅਸੀਂ ਬਹੁਤ ਜ਼ਿਆਦਾ ਸਮਾਨ ਤੁਹਾਡੇ ਤੋਂ ਔਡਰ ਕੀਤਾ ਸੀ ਅਤੇ ਤੁਹਾਡੇ ਤੋਂ ਹੀ ਕਰਦੇ ਆ ਰਹੇ ਹਾਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਸਾਨੂੰ ਕੁਛ ਪ੍ਰਸੈਂਟ ਡਿਸਕਾਊਂਟ ਕੂਪਨ ਦਿੱਤਾ ਜਾਵੇ ਜ ਅਤੇ ਅਸੀਂ ਵੀ ਤੁਹਾਡੀ ਪ੍ਰਮੋਸ਼ਨ ਕਰਾਂਗੇ ਕਿਉਂਕਿ ਮੈਨੂੰ ਵਾਧੂ ਬਹੁਤ ਸਾਰੇ ਮੇਰੇ ਯਾਰ ਦੋਸਤ ਜਾਣਦੇ ਨੇ ਅਤੇ ਸਾਡੇ ਰਿਸ਼ਤੇਦਾਰੀ ਦੇ ਵਿੱਚ ਵੀ ਅਸੀਂ ਇਹੋ ਜਿਹੇ ਫੰਕਸ਼ਨ ਕਰਵਾਉਂਦੇ ਰਹਿੰਦੇ ਹਾਂ ਅਤੇ ਤੁਹਾਡੀ ਉੱਥੇ ਅਸੀਂ ਪ੍ਰਮੋਸ਼ਨ ਵੀ ਕਰਾਂਗੇ ਅਤੇ ਦੱਸਾਂਗੇ ਵੀ ਤੁਹਾਡਾ ਬਹੁਤ ਵਧੀਆ ਖਾਣਾ ਹੁੰਦਾ ਬਹੁਤ ਵਧੀਆ ਤੁਹਾਡੀ ਫੀਡਬੈਕ ਦੇਵਾਂਗੇ ਅਤੇ ਦੱਸਾਂਗੇ ਕਿ ਬਹੁਤ ਹੀ ਵਧੀਆ ਅਤੇ ਬਿਨਾ ਕੰਪਲੇਂਟ ਵਾਲਾ ਹੁੰਦਾ ਅਤੇ ਜ਼ਿਆਦਾ ਸਮਾਨ ਲੈਣ ਨਾਲ ਆਪਾਂ ਨੂੰ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ ਧੰਨਵਾਦ